ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਆਪਣੇ ਰਾਜ ਦੀ ਸੱਭਿਆਚਾਰ ਪੰਜਾਬੀ ਭਾਸ਼ਾ ਬਾਰੇ ਕੁਝ ਵਿਚਾਰ ਸਾਂਝੇ ਕਰਾਂਗੀ ਸਾਡੇ ਰਾਜ ਦੀ ਪੰਜਾਬੀ ਭਾਸ਼ਾ ਪੰਜਾਬੀ ਬੋਲੀ ਜਿਹਨੂੰ ਕਿ ਪੰਜਾਬੀ ਮਾਂ ਬੋਲੀ ਵੀ ਕਿਹਾ ਜਾਂਦਾ ਹੈ ਸਭ ਤੋਂ ਜ਼ਿਆਦਾ ਆਪਸੀ ਗੱਲਬਾਤ ਵਿੱਚ ਬੋਲੀ ਜਾਣ ਵਾਲੀ ਭਾਸ਼ਾ ਹੈ ਸਾਡੀ ਮਾਂ ਬੋਲੀ ਮਾਤ ਬੋਲੀ ਜਿਹਨੂੰ ਕਿ ਮਾਤ ਬੋਲੀ ਵੀ ਕਿਹਾ ਜਾਂਦਾ ਹੈ ਪੰਜਾਬੀ ਹੈ ਇਨਸਾਨ ਦਾ ਆਪਣੀ ਮਾਂ ਨਾਲ ਜਿਵੇਂ ਗੂੜਾ ਸਬੰਧ ਹੁੰਦਾ ਹੈ ਉਸੇ ਤਰ੍ਹਾਂ ਹੀ ਜਦੋਂ ਮਾਂ ਇਨਸਾਨ ਨੂੰ ਜਨਮ ਦਿੰਦੀ ਹੈ ਅਤੇ ਬੱਚਾ ਮਾਂ ਕੋਲੋਂ ਜਿਹੜੀ ਬੋਲੀ ਸਿੱਖਦਾ ਹੈ ਉਸ ਨੂੰ ਮਾਂ ਬੋਲੀ ਜਾਂ ਮਾਤ ਬੋਲੀ ਕਿਹਾ ਜਾਂਦਾ ਹੈ ਮਾਂ ਹੀ ਆਪਣੇ ਬੱਚੇ ਨੂੰ ਆਪਣੀ ਉਸ ਬੋਲੀ ਵਿੱਚ ਜ਼ਿੰਦਗੀ ਦੇ ਅਰਥ ਸਮਝਾਉਂਦੀ ਹੈ ਪੰਜਾਬੀ ਭਾਸ਼ਾ ਵਿੱਚ ਸਾਡੇ ਗੁਰੂਆਂ ਨੇ ਬਾਣੀ ਰਚੀ ਪੰਜਾਬੀ ਭਾਸ਼ਾ ਵਿੱਚ ਸਾਡੇ ਗੀਤਕਾਰਾਂ ਨੇ ਗੀਤ ਲਿਖੇ ਪੰਜਾਬੀ ਭਾਸ਼ਾ ਵਿੱਚ ਕਵੀਆਂ ਨੇ ਗਾਥਾ ਗਾਈਆਂ ਇੱਥੋਂ ਤੱਕ ਕਿ ਦਿਨ ਤਿਉਹਾਰ ਗੁਰਪੁਰਬ ਮੇਲਿਆਂ ਵਿੱਚ ਵੀ ਪੰਜਾਬੀ ਭਾਸ਼ਾ ਦੇ ਅਲੱਗ ਅਲੱਗ ਰੂਪ ਵੇਖਣ ਨੂੰ ਮਿਲਦੇ ਹਨ ਮੇਲਿਆਂ ਵਿੱਚ ਭੰਗੜੇ ਦੇ ਰੂਪ ਵਿੱਚ ਗਿੱਧੇ ਦੇ ਰੂਪ ਵਿੱਚ ਪੰਜਾਬੀ ਭਾਸ਼ਾ ਦੇਖਣ ਨੂੰ ਮਿਲਦੀ ਹੈ ਗੁਰਦੁਆਰਿਆਂ ਵਿੱਚ ਪੰਜਾਬੀ ਬਾ ਪੰਜਾਬੀ ਭਾਸ਼ਾ ਵਿੱਚ ਬਾਣੀ ਪੜ੍ਹੀ ਜਾਂਦੀ ਹੈ ਕਵੀਸ਼ਰ ਗੁਰੂਆਂ ਦੀਆਂ ਕਾਫੀਆਂ ਗਾਉਂਦੇ ਹਨ ਢਾਡੀ ਵਾਰਾਂ ਸੁਣਾਉਂਦੇ ਹਨ ਅਤੇ ਕਥਾਵਾਂ ਸੁਣਾਉਂਦੇ ਹਨ ਹਰ ਖੇਤਰ ਵਿੱਚ ਦੇਖਿਆ ਜਾਵੇ ਤਾਂ ਪੰਜਾਬੀ ਸਭ ਤੋਂ ਉੱਤਮ ਅਤੇ ਮਿੱਠ ਬੋਲੜੀ ਭਾਸ਼ਾ ਹੈ ਪੰਜਾਬੀ ਬੋਲੀ ਦੀ ਰਚਨਾ ਸਾਡੇ ਗੁਰੂਆਂ ਨੇ ਕੀਤੀ ਇਸ ਕਰਕੇ ਪੰਜਾਬੀ ਮਾਂ ਬੋਲੀ ਦਾ ਸਤਿਕਾਰ ਵੀ ਕੀਤਾ ਜਾਂਦਾ ਹੈ ਪੰਜਾਬੀ ਬੋਲੀ ਵਿੱਚ ਹੀ ਸਾਨੂੰ ਇਨਸਾਨ ਤੋਂ ਇਨਸਾਨ ਦੀ ਪਹਿਚਾਣ ਹੁੰਦੀ ਹੈ ਪੰਜਾਬੀ ਬੋਲੀ ਵਿੱਚ ਅਸੀਂ ਆਪਸੀ ਗੱਲਬਾਤ ਕਰਦੇ ਹਾਂ ਇੱਕ ਦੂਜੇ ਨਾਲ ਮੇਲ ਜੋਲ ਵਧਾਉਂਦੇ ਹਾਂ ਅਤੇ ਆਪਣੇ ਵਿਚਾਰ ਸਾਂਝੇ ਕਰਦੇ ਹਾਂ ਪੰਜਾਬੀ ਬੋਲੀ ਇੱਕ ਅਹਿਮ ਭਾਸ਼ਾ ਹੈ ਸਾਡੇ ਰਾਜ ਦੀ ਭਾਸ਼ਾ ਹੈ ਸਾਨੂੰ ਮਾਣ ਹੈ ਕਿ ਅਸੀਂ ਪੰਜਾਬੀ ਬੋਲੀ ਬੋਲ ਰਹੇ ਹਾਂ ਉਸ ਰਾਜ 'ਚ ਜਨਮ ਲਿਆ ਹੈ ਜਿੱਥੇ ਕਿ ਪੰਜਾਬੀ ਬੋਲੀ ਅਤੇ ਪੜ੍ਹੀ ਜਾਂਦੀ ਹੈ ਧੰਨਵਾਦ